ਹਾਂਜੀ ਮੈਂ ਬਿਮਾਰੀਆਂ ਦਾ ਇਲਾਜ ਕਰਨ ਲਈ ਹਸਪਤਾਲ ਜਾਣਾ ਜ਼ਿਆਦਾ ਪਸੰਦ ਨਹੀਂ ਕਰਦੀ ਜਿਵੇਂ ਕਿ ਸਿਰ ਦਰਦ ਹੋ ਗਿਆ ਕੋਲਡ ਕੱਫ ਹੋ ਗਿਆ ਈਅਰ 'ਚ ਪੇਨ ਹੈ ਆਈਸ 'ਚ ਪੇਨ ਹੈ ਇਹਦੇ ਲਈ ਮੈਨੂੰ ਜ਼ਿਆਦਾ ਹੁੰਦਾ ਹੈ ਕਿ ਮੈਂ ਘਰੇਲੂ ਇਲਾਜ ਕਰਾਂ ਜਿਵੇਂ ਕਿ ਹੁਣ ਆਪਾਂ ਕਹਿ ਦਿੰਦੇ ਹਾਂ ਕੱਫ਼ ਕੋਲਡ ਹੈ ਇਹਦੇ ਲਈ ਤੁਸ ਤੁਸੀਂ ਤੁਲਸੀ ਅਦਰਕ ਸ਼ਹਿਦ ਕਾਲੀ ਮਿਰਚ ਦਾ ਹੀ ਕਰਕੇ ਮਿਕਚਰ ਬਣਾ ਕੇ ਪੀ ਸਕਦੇ ਹੋ ਤਾਂ ਇਸ ਨਾਲ ਤੁਹਾਡੀ ਕੱਫ ਠੀਕ ਹੋ ਜਾਂਦੀ ਹੈ ਸਿਰ ਦਰਦ ਲਈ ਸਾਨੂੰ ਜੇ ਲੱਗਦਾ ਹੈ ਤਾਂ ਅਸੀਂ ਚਾਹ ਪੀ ਕੇ ਵੀ ਸਿਰ ਦਰਦ ਠੀਕ ਕਰ ਸਕਦੇ ਹਾਂ ਜਿਵੇਂ ਕਿ ਹੁਣ ਪੇਟ ਦਰਦ ਹੈ ਇਹਦੇ ਲਈ ਤੁਸੀਂ ਅਜਵੈਨ ਸੋਂਫ ਦਾ ਪਾਣੀ ਪੀ ਲਓ ਤਾਂ ਮੈਨੂੰ ਜ਼ਿਆਦਾ ਬੈਸਟ ਲੱਗਦਾ ਹੈ ਕਿ ਜੇ ਅਸੀਂ ਘਰੇਲੂ ਉਪਚਾਰ ਕਰਕੇ ਆਪਣੀ ਬਿਮਾਰੀ ਨੂੰ ਠੀਕ ਕਰ ਸਕਦੇ ਹਾਂ ਉਹ ਜ਼ਿਆਦਾ ਬੈਸਟ ਹੈ ਕਿਉਂਕਿ ਦੇਖੋ ਹੋਸਪਿਟਲਾਂ 'ਚ ਆਪਾਂ ਨੂੰ ਲੱਗਦਾ ਜੇ ਆਪਾਂ ਜਾਈਏ ਤਾਂ ਕੋਈ ਵੱਡੀ ਬਿਮਾਰੀ ਹੋ ਜਾਏ ਮਤਲਬ ਵੱਡੀ ਇੰਜ਼ਰੀ ਹੋ ਜਾਏ ਤਾਂ ਸਾਨੂੰ ਹੋਸਪਿਟਲ ਜਾਣਾ ਪ੍ਰੈਫਰ ਕਰੂੰਗੀ ਜਿਵੇਂ ਛੋਟੀ ਜਿਹੀ ਜਾਂ ਇੰਜ਼ਰੀ ਹੁੰਦੀ ਹੈ ਜਿਵੇਂ ਕਿ ਕੋਈ ਸੱਟ ਲੱਗ ਗਈ ਤਾਂ ਉਹਦੇ ਉਹਨੂੰ ਆਪਾਂ ਮਤਲਬ ਸਰੋਂ ਦਾ ਤੇਲ ਗਰਮ ਕਰਕੇ ਹਲਦੀ ਲਗਾ ਲਈ ਹਲਦੀ ਵਾਲਾ ਦੁੱਧ ਪੀ ਲਿਆ ਤਾਂ ਮੈਨੂੰ ਲੱਗਦਾ ਹੈ ਕਿ ਜਿਆਦਾ ਬੈਸਟ ਹੈ ਘਰੇਲੂ ਉਪਚਾਰ ਠੀਕ ਹੈ ਠੀਕ ਹੈ ਜੇ ਅਸੀਂ ਬੜੀ ਕੋਈ ਇੰਜ਼ਰੀ ਲਈ ਸਾਨੂੰ ਲੱਗਦਾ ਹੈ ਕਿ ਜਾਣਾ ਪੈਣਾ ਹੈ ਪੈਂਦਾ ਹੈ ਉਹਦੇ ਲਈ ਫਿਰ ਅਸੀਂ ਆਪਾਂ ਪਹਿਲਾਂ ਹੋਸਪਿਟਲ ਜਾਣ ਤੋਂ ਪਹਿਲਾਂ ਸਰਚ ਕਰਦੇ ਹਾਂ ਕਿ ਕਿਹੜੇ ਡੋਕਟਰ ਲਈ ਕਿਹੜੇ ਚੀਜ਼ 'ਚ ਸਪੈਸ਼ਲਾਈਜੇਸ਼ਨ ਹੈ ਮਤਲਬ ਜੇ ਸਾਡੇ ਪੇਟ 'ਚ ਕੋਈ ਪ੍ਰੋਬਲਮ ਹੈ ਅਸੀਂ ਗੈਸਟਰੋ ਦਾ ਡੋਕਟਰ ਦੇਖਦੇ ਹਾਂ ਹਾਰਟ ਹਾਰਟ ਦੀ ਕੋਈ ਪ੍ਰੋਬਲਮ ਹੈ ਤਾਂ ਅਸੀਂ ਕਾਰਡੀਓ ਦਾ ਡੋਕਟਰ ਦੇਖਦੇ ਹਾਂ ਬੈਸਟ ਡੋਕਟਰ ਕਿਹੜਾ ਹੈ ਜਿਹੜਾ ਸਾਨੂੰ ਗਲਤ ਚੱਕਰਾ 'ਚ ਨਾ ਪਾਵੇ ਕਿ ਸਾਡਾ ਇਲਾਜ ਸਹੀ ਤਰ੍ਹਾਂ ਕਰੇ ਤਾਂ ਉਸ ਲਈ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਹ ਇਸ ਚੀਜ਼ ਦੀ ਸਪੈਸ਼ਲਾਈਜੇਸ਼ਨ ਹੈਗੀ ਹੈ ਤਾਂ ਮੈਂ ਹੋਸਪਿਟਲ ਜਾਣਾ ਪ੍ਰੈਫਰ ਕਰਦੀ ਹਾਂ ਮੈਨੂੰ ਮੋਸਟਲੀ ਹੁੰਦਾ ਹੈ ਵੀ ਜੇ ਕੋਈ ਛੋਟੀ ਮੋਟੀ ਬਿਮਾਰੀ ਹੈ ਛੋਟੀ ਮੋਟੀ ਇੰਜ਼ਰੀ ਹੈ ਤਾਂ ਉਹਨੂੰ ਮੈਂ ਘਰੇਲੂ ਉਪਚਾਰ ਦੀ ਸਹਾਇਤਾ ਨਾਲ ਹੀ ਠੀਕ ਕਰ ਲਵਾਂ ਥੈਂਕ ਯੂ